ਹੈਲੋ

ਹਾਂਜੀ ਆਸ਼ਰਮ ਸਰ ਹਾਂ ਆਪਣੇ ਇੱਥੇ ਸ਼ਹਿਰ ਦੇ ਨਾਲ ਹੀ ਹੈ ਇੱਥੇ ਛੇ ਸੱਤ ਕਿਲੋਮੀਟਰ ਦੂਰ 'ਤੇ ਉਹ ਸਮਾਧ ਬਣੀ ਜੀ ਇਹ ਸ਼ਹੀਦਾਂ ਦੀ ਇੱਥੇ ਲੋਕ ਆਉਂਦੇ ਨੇ ਦੂਰ ਦੂਰ ਤੋਂ ਘੁੰਮਣ ਇੱਥੇ ਅਤੇ ਬੜਾ ਵਧੀਆ ਜਗਾ ਬੜਾ ਅਰਾਮ ਨਾਲ ਉੱਥੇ ਤੁਸੀਂ ਰਹਿ ਸਕਦੇ ਹੋ ਸਾਰਾ ਦਿਨ ਬਿਤਾ ਸਕਦੇ ਹੋ ਖਾ ਪੀ ਸਕਦੇ ਹੋ ਕੰਨਟੀਨ ਬਣੀਆਂ ਹੋਈਆਂ ਨੇ ਹੋਰ ਕੋਈ ਇੱਥੇ ਟਿਕਟ ਵਗੈਰਾ ਵੀ ਇੱਥੇ ਨਹੀਂ ਨਹੀਂ ਫਰੀ ਹੈ ਕੋਈ ਐਸੀ ਗੱਲ ਨਹੀਂ ਤੁਸੀਂ ਅੰਦਰ ਪਾਰਕ ਬੜਾ ਵਧੀਆ ਬਣਿਆ ਤੁਸੀਂ ਰਹਿ ਸਕਦੇ ਹੋ ਖਾਣ ਪੀਣ ਦਾ ਅਰੇਜਮੈਂਟ ਵੀ ਬੜਾ ਵਧੀਆ ਬਣਿਆ ਅੰਦਰ ਕੰਨਟੀਨ ਬਣੀ ਹੋਈ ਹੈ ਔਰ ਇੱਥੇ ਤੁਸੀਂ ਕੀ ਕਿ ਕਿਹੜੇ ਸ਼ਹਿਰ ਤੋਂ ਸਾਨੂੰ ਸਾਨੂੰ ਇੱਥੇ ਫਾਜ਼ਿਲਕਾ ਤੇ ਢਾਈ ਸੌ ਕਿਲੋਮੀਟਰ ਦਾ ਏਰੀਆ ਹੈ ਕਿ ਤੁਹਾਨੂੰ ਲੱਗ ਜਾਣਗੇ ਤਿੰਨ ਚਾਰ ਘੰਟੇ ਆਪ ਦੀ ਕਾਰ 'ਤੇ ਆਓਗੇ ਤਾਂ ਅੱਗੋਂ ਆਪਣੇ ਸ਼ਹਿਰ ਤੋਂ ਤਾਂ ਛੇ ਸੱਤ ਕਿਲੋਮੀਟਰ ਦੂਰ 'ਤੇ ਨੇੜੇ ਹੀ ਹੈ ਕੋਈ ਜ਼ਿਆਦਾ ਦੂਰ ਨਹੀਂ ਹੈ ਅੰਦਰ ਸ਼ਹੀਦਾਂ ਦੀਆਂ ਜੋ ਵੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਜੰਗ ਲੜੀ ਸੀ ਉਹਨਾਂ ਦਾ ਪੂਰਾ ਵੇਰਵਾ ਦਿੱਤਾ ਹੋਇਆ ਅਤੇ ਉਸ ਟਾਈਮ 'ਚ ਅਤੇ ਸੀਲ ਤੁਹਾਨੂੰ ਇੱਥੇ ਆਪਣੇ ਆਪਣੇ ਇੱਧਰਦੇ ਇਲਾਕੇ ਦੇ ਜਿਹੜੇ ਵੀ ਬਦਲੇ ਹੈਗੇ ਸੀ ਅਤੇ ਫੌਜੀਆਂ ਨੇ ਜਿਨ੍ਹਾਂ ਨੇ ਜੰਗ ਲੜੀ ਸੀ ਜਿਹੜੀ ਤਰੀਕ ਨੂੰ ਲੜੀ ਸੀ ਕਿੰਨੇ ਫੌਜੀ ਆਪਣੇ ਇੱਥੇ ਸ਼ਹੀਦ ਹੋਏ ਸੀ ਉਹਨਾਂ ਦੇ ਕਿੰਨੇ ਮਰੇ ਸੀ ਉਹ ਸਾਰੀ ਡਿਟੇਲ ਤੁਹਾਨੂੰ ਇੱਥੇ ਇੱਕ ਇੱਕ ਚੀਜ਼ ਬਰੀਕੀ ਨਾਲ ਮਿਲ ਜਾਵੇਗੀ ਤੁਸੀਂ ਜਦੋਂ ਆਓਗੇ ਨਾ ਇੱਥੇ ਹਾਂਜੀ ਹਾਂਜੀ ਬੜੀ ਵਧੀਆ ਵੇਖਣ ਵਾਲੀ ਜਗ੍ਹਾ 'ਤੇ ਇਹ ਤਾਂ ਲੋਕ ਪੂਰੇ ਪੰਜਾਬ ਤੋਂ ਆਉਂਦੇ ਨੇ ਪੰਜਾਬ ਤੋਂ ਬਾਹਰ ਵੀ ਇੱਥੇ ਗੁੰਮਣ ਵਾਸਤੇ ਆਉਂਦੇ ਰਹਿੰਦੇ ਨੇ ਤੁਸੀਂ ਆਓਗੇ ਤਾਂ ਪਤਾ ਲੱਗੇਗਾ ਇੱਕ ਵਾਰੀ ਤੁਸੀਂ ਦੇਖੋ ਇੱਥੇ ਆ ਕੇ ਲੋਕ ਪਿਕਨਿਕ ਮਨਾਉਂਦੇ ਨੇ ਇੱਥੇ ਸਕੂਲਂ ਦੇ ਕਾਲਜਾਂ ਦੇ ਬੱਚੇ ਇੱਥੇ ਘੁੰਮਣ ਆਉਂਦੇ ਨੇ ਹਾਂਜੀ ਹਾਂਜੀ ਇੱਥੇ ਹਰ ਸਾਲ ਹੀ ਇੱਥੇ ਹਰ ਸਾਲ ਸ਼ਹੀਦਾਂ ਦੇ ਜਨਮ ਦਿਹਾੜੇ 'ਤੇ ਉਹਨਾਂ ਦੀ ਸ਼ਰਧਾਂਜਲੀ ਦਿਵਸ ਤੇ ਪ੍ਰੋਗਰਾਮ ਰੱਖੇ ਜਾਂਦੇ ਨੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਸੰਸਕ੍ਰਿਤ ਕਾਰਿਆਕ੍ਰਮ ਹੁੰਦੇ ਨੇ ਬੜਾ ਵਧੀਆ ਮਾਹੌਲ ਹੁੰਦਾ ਬੜਾ ਵੇਖਣ ਵਾਲਾ ਹੁੰਦਾ ਬਹੁਤ ਰੌਣਕ ਲੱਗਦੀ ਉੱਥੇ ਹਾਂਜੀ ਹਾਂਜੀ ਠੀਕ ਹੈ ਜੀ